ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੈਂ ਤੁਹਾਡੇ ਤੋਂ ਫੋਨ ਖਰੀਦਿਆ ਸੀਗਾ ਜੋ ਸੈਮਸੰਗ ਦਾ ਇੱਕ ਤਾਂ ਉਹਦੀ ਡਿਲੀਵਰੀ ਬਹੁਤ ਲੇਟ ਦਿੱਤੀ ਹੈ ਤੁਸੀਂ ਅਤੇ ਦੂਜੀ ਗੱਲ ਜਦੋਂ ਮੈਂ ਬੋਕਸ ਓਪਨ ਕੀਤਾ ਅਤੇ ਉਹਦੇ 'ਤੇ ਸਕਰੈਚ ਪਏ ਹੋਏ ਤੇ ਸਾਰੇ ਫੋਨ 'ਤੇ ਅਤੇ ਪਲੱਸ ਸਕਰੀਨ ਗਾਰਡ ਵੀ ਉਤਰਿਆ ਹੋਇਆ ਸੀ ਅਤੇ ਹੋਰ ਤਾਂ ਹੋਰ ਉਹਦੇ ਵਿੱਚ ਹੈੱਡਫੋਨ ਵੀ ਨਹੀਂ ਸੀ ਹੈਗੇ ਜਦੋਂ ਮੈਂ ਫੋਨ ਔਨ ਕੀਤਾ ਯੂਜ਼ ਕੀਤਾ ਫੋਨ ਤਾਂ ਉਹਦੇ ਸਪੀਕਰ ਵਿੱਚੋਂ ਆਵਾਜ਼ ਹੀ ਨਹੀਂ ਸੀ ਆਉਂਦੀ ਜਦੋਂ ਆਵਾਜ਼ ਆਉਂਦੀ ਹੈ ਕਈ ਵਾਰੀ ਤਾਂ ਉਹ ਵੀ ਫਟੀ ਹੋਈ ਆਉਂਦੀ ਹੈ ਅਤੇ ਕੈਮਰਾ ਕੈਮਰਾ ਇਹਦਾ ਬਿਲਕੁਲ ਬੇਕਾਰ ਹੈ ਭਾਅ ਜੀ ਬਿਲਕੁਲ ਬੇਕਾਰ ਹੈ ਇਹਦੇ ਨਾਲੋਂ ਤਾਂ ਮੇਰੇ ਪਹਿਲਾਂ ਵਾਲੇ ਫੋਨ ਦਾ ਕੈਮਰਾ ਵਧੀਆ ਸੀ ਅਤੇ ਇੰਟਰਨੈੱਟ ਵੀ ਬੜਾ ਸਲੋਅ ਚੱਲਦਾ ਇਹਦੇ ਕਈ ਵਾਰ ਤਾਂ ਇਹਦੇ ਟਾਵਰ ਹੀ ਉੱਡ ਜਾਂਦੇ ਨੈਟਵਰਕ ਉੱਡ ਜਾਂਦੇ ਹੈ ਭਾਅ ਜੀ ਹੋਰ ਤਾਂ ਹੋਰ ਜਦੋਂ ਇਹਨੂੰ ਚਾਰਜਰ 'ਤੇ ਲਗਾਉਂਦਾ ਹੈ ਤਾਂ ਚਾਰਜਰ ਹੀ ਨਹੀਂ ਹੁੰਦਾ ਹੈਗਾ ਅਤੇ ਬੈਟਰੀ ਪੈਕਅਪ ਵੀ ਬਹੁਤ ਘੱਟ ਆ ਭਾਅ ਜੀ ਇਹਦਾ